ਆਪਣੇ ਵਿਹਲੇ ਸਮੇਂ ਦੇ ਵਿੱਚ ਮੈਂ ਕਈ ਕਿਤਾਬਾਂ ਪੜ੍ਹਦੀ ਹਾਂ ਅਤੇ ਮੈਨੂੰ ਕਿਤਾਬ ਪੜ੍ਹਨ ਦਾ ਬਹੁਤ ਸ਼ੌਂਕ ਆ ਅਤੇ ਮੇਰੀ ਸਹੇਲੀ ਨੇ ਮੈਨੂੰ ਇੱਕ ਕਿਤਾਬ ਦਿੱਤੀ ਸੀ ਜਿਹਦਾ ਜਿਹੜੀ ਕਿ ਸੁਆਮੀ ਯੋਗੀ ਦੀ ਜੀਵਨ ਰਚਨਾ ਹੈ ਅਤੇ ਇਹ ਕਿਤਾਬ ਦੀ ਲੈਂਥ ਵੇਖ ਕੇ ਪਹਿਲਾਂ ਤਾਂ ਮੈਂ ਆਪਣਾ ਹੌਂਸਲਾ ਹੀ ਹਾਰ ਤਾ ਕਿ ਮੈਂ ਨਹੀਂ ਪੜ੍ਹਨ ਲੱਗੀ ਇਹ ਕਿਤਾਬ ਬਟ ਅੰਤ ਵਿੱਚ ਜਦੋਂ ਮੈਂ ਸੋਚਿਆ ਮੈਂ ਕਿਹਾ ਨਹੀਂ ਪੜ੍ਹਦੇ ਹਾਂ ਇਹ ਕਿਤਾਬ ਕਿਉਂਕਿ ਵਾਪਸ ਵੀ ਕਰਨੀ ਸੀ ਉਹਨੂੰ ਅਤੇ ਜਦੋਂ ਮੈਂ ਪਹਿਲਾ ਚੈਪਟਰ ਪੜ੍ਹਿਆ ਮੈਨੂੰ ਤਾਂ ਪਹਿਲਾ ਪ ਚੈਪਟਰ ਸਮਝ ਹੀ ਨਾ ਆਵੇ ਮੈਂ ਕਿਹਾ ਲਿਖਿਆ ਕੀ ਹੋਇਆ ਇਹਨੇ ਕਹਿਣਾ ਕੀ ਚਾਹੁੰਦਾ ਅਤੇ ਉਸ ਤੋਂ ਬਾਅਦ ਮੈਂ ਦੁਬਾਰਾ ਪੜ੍ਹੀ ਉਹ ਚੀਜ਼ ਫਿਰ ਉਸ ਤੋਂ ਬਾਅਦ ਦੂਜਾ ਚੈਪਟਰ ਪੜ੍ਹਿਆ ਤੀਜਾ ਚੈਪਟਰ ਪੜ੍ਹਿਆ ਅਤੇ ਮੈਨੂੰ ਸਮਝ ਆਉਣ ਲੱਗੀ ਕਿ ਉਹਨੇ ਕੀ ਉਹਨਾਂ ਨੇ ਕਿਵੇਂ ਜੀਵਨ ਦੀਆਂ ਰਚਨਾ ਬਾਰੇ ਦੱਸਿਆ ਅਤੇ ਕਿਵੇਂ ਦੱਸਿਆ ਕਿ ਜਿਹੜਾ ਯੋਗ ਆ ਉਹ ਸਾਨੂੰ ਕਰਨਾ ਚਾਹੁੰਦਾ ਚਾਹੀਦਾ ਅਤੇ ਇਨਸਾਨ ਲਈ ਉਹ ਕਿੰਨੀ ਜ਼ਿਆਦਾ ਸਹਾਇਕ ਹੈ ਅਤੇ ਯੋਗਾ ਕਰਨ ਨਾਲ਼ ਸਾਨੂੰ ਕਿੰਨੀ ਕੁ ਲਾਭ ਹੁੰਦੇ ਨੇ ਸਾਡੀ ਸਿਹਤ 'ਤੇ ਉਸ ਚੀਜ਼ ਦਾ ਕੀ ਪ੍ਰਭਾਵ ਪੈਂਦਾ ਅਤੇ ਹੌਲੀ ਹੌਲੀ ਜਿਵੇਂ ਮੈਂ ਇਹ ਕਿਤਾਬ ਪੜ੍ਹਦੀ ਗਈ ਅਤੇ ਮੈਨੂੰ ਇਹ ਕਿਤਾਬ ਨਾਲ਼ ਪਿਆਰ ਹੁੰਦਾ ਗਿਆ ਅਤੇ ਮੈਨੂੰ ਬਹੁਤ ਵਧੀਆ ਲੱਗੀ ਅਤੇ ਮੈਨੂੰ ਲੱਗਿਆ ਕਿ ਇਹਨੂੰ ਮੈਂ ਪੂਰਾ ਪੜ੍ਹਨਾ ਚਾਹੀਦਾ ਅਤੇ ਇਹ ਕਿਤਾਬ ਮੈਂ ਪੂਰੀ ਵੀ ਕੀਤੀ ਅਤੇ ਇਸਦੇ ਨਾਲ਼ ਨਾਲ਼ ਇਸ ਕਿਤਾਬ ਨੂੰ ਮੈਨੂੰ ਲੱਗਦਾ ਮੈਂ ਦੋ ਤਿੰਨ ਵਾਰ ਤਾਂ ਪੜ੍ਹ ਹੀ ਚੁੱਕੀ ਹਾਂ ਅਤੇ ਹੁਣ ਵੀ ਜਦੋਂ ਵੀ ਮੈਂ ਇਸ ਕਿਤਾਬ ਨੂੰ ਪੜ੍ਹਦੀ ਹਾਂ ਤਾਂ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਮੇਰਾ ਦਿਲ ਕਰਦਾ ਕਿ ਮੈਂ ਕਿਤਾਬ ਨੂੰ ਅੱਗੇ ਹੋਰ ਪੜ੍ਹਾਂ ਅਤੇ ਮੈਂ ਇਸ ਤੋਂ ਹੋਰ ਸਿੱਖਿਆ ਲਵਾਂ